ਲੋਕਡਾਊਨ ਵਿੱਚ ਲੋਕਾਂ ਨੇ ਮੋਬਾਇਲ ਲੈਪਟਾਪ ਦੀ ਵਰਤੋਂ ਬਹੁਤ ਜਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਸ ਸਮੇਂ ਇਹਨਾਂ ਕੋਲ ਕੋਈ ਹੋਰ ਕੰਮ ਨਹੀਂ ਸੀ ਹੁੰਦਾ ਕਰੋਨਾ ਨੇ ਲੋਕਾਂ ਨੂੰ ਘਰ ਵਿੱਚ ਬੰਦੀ ਬਣਾ ਦਿੱਤਾ ਸੀ ਔਨਲਾਈਨ ਸਕੂਲ ਅਤੇ ਕੰਮ ਵੀ ਘਰ ਤੋਂ ਹੀ ਕਰਨਾ ਪੈਂਦਾ ਸੀ ਤਾਂ ਕੋਈ ਹੋਰ ਔਪਸ਼ਨ ਨਾ ਹੋਣ ਕਰਕੇ ਲੋਕਾਂ ਨੇ ਇਸ ਨੂੰ ਹੀ ਆਪਣਾ ਜ਼ਰੀਆ ਬਣਾ ਲਿਆ ਉਦੋਂ ਹੀ ਇਸ ਨੂੰ ਮਨੋਰੰਜਨ ਦਾ ਸਾਧਨ ਵੀ ਬਣਾ ਦਿੱਤਾ ਗਿਆ ਲੋਕਾਂ ਨੂੰ ਮੁਫਤ ਵਿੱਚ ਨੈੱਟ ਮਿਲਦਾ ਅਤੇ ਇਸ ਵਿੱਚ ਸਭ ਕੁਝ ਦੇਖਣ ਨੂੰ ਮਿਲਦਾ ਤਾਂ ਇਸਦੀ ਆਦਤ ਲੱਗਦੀ ਗਈ ਘਰ ਤੋਂ ਕੰਮ ਕਰਨ ਵਿੱਚ ਮੇਰਾ ਤਜਰਬਾ ਕੁੱਝ ਖੱਟਾ ਮਿੱਠਾ ਸੀ ਜਿੱਥੇ ਮੈਨੂੰ ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਿਆ ਜਿਵੇਂ ਕਿ ਕਿਸ ਤਰ੍ਹਾਂ ਦੇ ਫੀਚਰ ਇਸ ਵਿੱਚ ਹੁੰਦੇ ਹਨ ਕਿਵੇਂ ਅਸੀਂ ਵੀਡੀਓ ਕਾਲ ਤੇ ਗੱਲ ਕਰ ਸਕਦੇ ਹਾਂ ਕਿਵੇਂ ਅਸੀਂ ਲੋਕਾਂ ਨਾਲ ਵਿਚਰਨਾ ਹੈ ਅਤੇ ਹੋਰ ਬਹੁਤ ਕੁਛ ਉੱਥੇ ਹੀ ਮੈਨੂੰ ਕੁਛ ਮੁਸੀਬਤਾਂ ਵੀ ਮਿਲੀਆਂ ਜਿਵੇਂ ਕਿ ਮੇਰੀ ਅੱਖਾਂ ਦੀ ਰੌਸ਼ਨੀ ਵਿੱਚ ਥੋੜ੍ਹਾ ਫਰਕ ਪਿਆ ਅਤੇ ਮੈਨੂੰ ਕੁਛ ਕੁਛ ਚੱਕਰ ਵੀ ਆਉਣ ਲੱਗ ਪਏ ਅਤੇ ਮੈਨੂੰ ਫੋਨ ਜਿਆਦਾ ਦੇਖਣ ਦੀ ਆਦਤ ਲੱਗ ਗਈ ਇਸ ਤਰ੍ਹਾਂ ਇਹ ਮੇਰੇ ਜੀਵਨ ਨੂੰ ਕੁਝ ਪ੍ਰਭਾਵਿਤ ਕਰਨ ਵਿੱਚ ਹਿੱਸਾ ਪਾਉਂਦਾ ਰਿਹਾ